ਬਾਕੀ ਜਿਹੜਾ ਦ ਜਿਵੇਂ ਲੰਗਰਾਂ ਦੇ ਵਿੱਚੋਂ ਜਾਂ ਹੋਰ ਜਿਹੜੇ ਰੈਸਟੋਰੈਂਟਸ ਦੇ ਵਿੱਚ ਜਿਹੜੇ ਫੂਡ ਵੇਸਟ ਹੁੰਦਾ ਉਸ ਨੂੰ ਵੀ ਕਿਤੇ ਔਰਗੈਨਿਕ ਡੰਪ ਬਣਾ ਕੇ ਉਹਦੇ 'ਚ ਔਰਗੈਨਿਕ ਜਿਹੜੀ ਖਾਦ ਤਿਆਰ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦਾ ਵੀ ਕੋਈ ਉਪਰਾਲਾ ਕੀਤਾ ਜਾਣਾ ਚਾਹੀਦਾ